ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸ਼ਾਹੀ ਹਵੇਲੀ ਤੋਂ ਬੋਲ ਰਹੇ ਹੋ ਭਾਰਤ ਨਗਰ ਹਾਂਜੀ ਮੈਂ ਭਾਰਤ ਨਗਰ ਇੱਕ ਸੌ ਅਠਾਨਵੇਂ 'ਚੋਂ ਬੋਲ ਰਹੀ ਹਾਂ ਐਨਮ ਮੈਂ ਪੀਣ ਲਈ ਕੁਛ ਔਡਰ ਕਰਨਾ ਸੀ ਤੁਹਾਡੇ ਕੋਲ ਕੀ ਕੀ ਹੈ ਪੀਣ ਵਿੱਚ ਜੂਸ ਹਾਂ ਜੂਸ ਕਿਸ ਪ੍ਰਕਾਰ ਦਾ ਹੈ ਕਿਹੜੇ ਕਿਹੜੇ ਟਾਈਪ ਹੈ ਜੂਸ ਦੇ ਮਿਕਸ ਫਰੂਟ ਠੀਕ ਹੈ ਮਿਕਸ ਫਰੂਟ ਕਰਨਾ ਹੋਏ ਤਾਂ ਕੀ ਕੌਸਟ ਆ ਉਹਦੀ ਠੀਕ ਹੈ ਨੱਬੇ ਰੁਪਏ ਅਤੇ ਲੱਸੀ ਹੈ ਆਪਣੇ ਕੋਲ ਮਿੱਠੀ ਲੱਸੀ ਲੈਣੀ ਮਲਾਈ ਵਾਲੀ ਹਾਂ ਉਹਦਾ ਕੀ ਚਾਰਜ ਪਏਗਾ ਆਪਾਂ ਨੂੰ ਠੀਕ ਹੈ ਮੈਨੂੰ ਦੋ ਗਲਾਸ ਲੱਸੀ ਚਾਹੀਦੇ ਹੈ ਇੱਕ ਮਿਕਸ ਫਰੂਟ ਅਤੇ ਜਦੋਂ ਲੈ ਕੇ ਆਓਗੇ ਤਾਂ ਗਰਮ ਤਾਂ ਨਹੀਂ ਹੋ ਜਾਏਗਾ ਹਾਂ ਹਾਂ ਕਿੰਨੇ ਟਾਈਮ 'ਚ ਡਿਲੀਵਰੀ ਕਰੋਗੇ ਠੀਕ ਹੈ ਠੀਕ ਹੈ ਫਿਰ ਅੱਧੇ ਘੰਟੇ 'ਚ ਹੁਣ ਜਿੱਦਾਂ ਸੱਤ ਵੱਜੇ ਹੈ ਤਾਂ ਮੈਨੂੰ ਸਾਢੇ ਸੱਤ ਤੱਕ ਆ ਜਾਏਗਾ ਹੈ ਨਾ ਤਾਂ ਮੈਂ ਕੈਸ਼ ਔਨ ਡਲੀਵਰੀ ਕਰਾਂਗੀ ਠੀਕ ਹੈ ਹਾਂ ਪਲੀਜ਼ ਤੁਸੀਂ ਭੇਜ ਵਾ ਦਿਓ ਫਿਰ ਜਲਦੀ ਅਤੇ ਆਪਣੇ ਕੋਲ ਗੂਗਲ ਪੇਅ ਦਾ ਔਪਸ਼ਨ ਵੀ ਹੈ ਚਲੋ ਮੈਂ ਔਨ ਦਾ ਸਪੋਟ ਦੇਖਲਾਂਗੀ ਕਿ ਗੂਗਲ ਪੇਅ ਕਰਨਾ ਹੈ ਦਾਂ ਕੈਸ਼ ਔਨ ਡਿਲੀਵਰੀ ਕਰਨਾ ਹੈ ਹਾਂਜੀ ਅਤੇ ਲੱਸੀ ਪਲੀਜ਼ ਮਲਾਈ ਵਾਲੀ ਹੋਣੀ ਚਾਹੀਦੀ ਹੈ ਅਤੇ ਕੋਕ ਹੈ ਆਪਣੇ ਕੋਲ ਹਾਂ ਇੱਕ ਕੋਕ ਕੋਕਾ ਕੋਲਾ ਉਹ ਭੇਜ ਦਿਓ ਹਾਂਜੀ ਠੀਕ ਹੈ ਜੀ ਥੈਂਕ ਯੂ